ਮੇਰੇ ਖੇਤਰ ਵਿੱਚ ਆਮ ਕਾਨੂੰਨੀ ਮੁੱਦੇ ਬਹੁਤ ਹੀ ਵਧੀਆ ਹਨ ਸਾਡੇ ਜਿਹੜੀ ਮੈਂ ਇੱਕ ਸੋਸਾਇਟੀ ਦੇ ਵਿੱਚ ਰਹਿੰਦੀ ਹਾਂ ਉੱਥੇ ਆਸ ਪਾਸ ਗਲੀਆਂ ਦੇ ਵਿੱਚ ਗੇਟ ਲੱਗੇ ਹੋਏ ਨੇ ਅਤੇ ਪਹਿਰੇਦਾਰ ਖੜ੍ਹਦਾ ਸਾਰੀ ਸਾਰੀ ਰਾਤ ਵਾਸਤੇ ਅਤੇ ਚੌਂਕੀਦਾਰ ਵੀ ਵਿੱਚ ਵਿੱਚ ਗੇੜਾ ਮਾਰ ਦਿੰਦਾ ਅਤੇ ਇੱਥੇ ਕੋਈ ਵੀ ਕੁਛ ਕਿਸੇ ਵੀ ਚੀਜ਼ ਦਾ ਕੋਈ ਡਰ ਨਹੀਂ ਹੈਗਾ ਕੈਮਰੇ ਵੀ ਲੱਗੇ ਹੋਏ ਪ੍ਰੋਪਰ ਸੇਫਟੀ ਹੈ ਇੱਥੇ ਅਤੇ